ਪੰਜਾਬ ਦੀ ਕਲਾ ਅਤੇ ਸ਼ਿਲਪਕਾਰੀ ਸਥਾਨਕ ਭਾਈਚਾਰੇ ਵਿੱਚ ਕਾਫ਼ੀ ਤਰ੍ਹਾਂ ਸ਼ਾਮਿਲ ਸੀ ਉਹ ਆਪਸ ਵਿੱਚ ਇੱਕ ਦੂਜੇ ਨਾਲ਼ ਸਮਰਥਨ ਵੀ ਕਰਦੇ ਸਨ ਔਰਤਾਂ ਇਕੱਠੀਆਂ ਹੋ ਕੇ ਕਢਾਈ ਕੱਢਦੀਆਂ ਸਨ ਫੁਲਕਾਰੀਆਂ ਬਣਾ ਕੇ ਉੱਪਰ ਲੈਂਦੀਆਂ ਸਨ ਅਤੇ ਇਕੱਠੀਆਂ ਬੈਠ ਕੇ ਜਦ ਉਹ ਇਹ ਕੰਮ ਕਰਦੇ ਸਨ ਉਹਨਾਂ ਵਿੱਚ ਇੱਕ ਆਪਸੀ ਸਹਿਯੋਗ ਅਤੇ ਭਾਈਚਾਰਾ ਬਣਿਆ ਰਹਿੰਦਾ ਸੀ ਸ਼ਿਲਪਕਾਰੀ ਵਿੱਚ ਵੀ ਕਈ ਤਰ੍ਹਾਂ ਦੀਆਂ ਕਲਾਵਾਂ ਸ਼ਾਮਿਲ ਹਨ ਜਿਵੇਂ ਲੋਕ ਪੱਥਰਾਂ 'ਤੇ ਲੱਕੜ 'ਤੇ ਇਕੱਠੇ ਹੋ ਕੇ ਕਾਫ਼ੀ ਤਰ੍ਹਾਂ ਦੀ ਸ਼ਿਲਪਕਾਰੀ ਕਰਦੇ ਸਨ ਅੱਜ ਵੀ ਜਦ ਮੇਲਿਆਂ ਵਿੱਚ ਜਾਂ ਪ੍ਰਦਰਸ਼ਨੀ ਵਿੱਚ ਜਦ ਲੋਕ ਇਕੱਠੇ ਹੁੰਦੇ ਹਨ ਤਾਂ ਉਹ ਵੀ ਆਪਸ ਵਿੱਚ ਸਾਂਝ ਬਣਾਉਂਦੇ ਹਨ ਅਤੇ ਇਸ ਤਰ੍ਹਾਂ ਕਲਾ ਅਤੇ ਸ਼ਿਲਪਕਾਰੀ ਨੂੰ ਅਗਾਂਹ ਤੱਕ ਪਹੁੰਚਾਉਂਦੇ ਹਨ